ਮੈਂ ਓਨਲਾਈਨ ਘੜੀ ਮੰਗਵਾਈ ਹੈ ਐਮਾਜੋਨ ਤੋਂ ਅਤੇ ਉਹ ਮੈਂ ਉੱਥੇ ਇੱਕ ਹੈਲਪਰ ਨਾਲ ਗੱਲ ਕੀਤੀ ਅਤੇ ਮੈਂ ਕਿਹਾ ਮੈਨੂੰ ਨਾ ਇੱਕ ਸਮਾਰਟਵਾਚ ਚਾਹੀਦੀ ਹੈ ਸੈਮਸੰਗ ਦੀ ਅਤੇ ਮੈਨੂੰ ਉਹ ਕਦੋਂ ਤੱਕ ਮਿਲ ਜਾਵੇਗੀ ਕਿਉਂਕਿ ਮੇਰੇ ਭਰਾ ਦਾ ਬਰਡੇ ਹੈ ਅਤੇ ਮੈਂ ਉਹਨੂੰ ਗਿਫਟ ਕਰਨੀ ਹੈ ਉਹਦਾ ਬਰਡੇ ਪੰਦਰਾਂ ਨੂੰ ਹੈ ਅਤੇ ਮੈਨੂੰ ਉਹ ਘੜੀ ਦਸ ਨੂੰ ਚਾਹੀਦੀ ਹੈ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਮੈਨੂੰ ਇਹ ਦਸ ਤਾਰੀਕ ਨੂੰ ਪਹਿਲ ਬਰਡੇ ਤੋਂ ਪਹਿਲਾਂ ਪਹਿਲਾਂ ਦਸ ਨੂੰ ਮਿਲ ਜਾਵੇਗੀ ਅਤੇ ਉਹ ਕਹਿੰਦੇ ਵੀ ਹਾਂ ਤੁ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਅਤੇ ਮੈਂ ਮੈਂ ਨਾ ਓਨਲਾਈਨ ਬਹੁਤ ਘੜੀਆਂ ਵੇਖੀਆਂ ਅਤੇ ਉਹਦੇ ਵਿੱਚੋਂ ਨਾ ਮੈਂ ਇੱਕ ਸਿਲੈਕਟ ਕਰਕੇ ਅਤੇ ਉਹ ਮੰਗਵਾਈ ਹੈ ਅਤੇ ਮੈਨੂੰ ਨਾ ਉਹ ਘੜੀ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਲੱਗਦੀ ਹੋਈ ਸੀ ਇਸ ਲਈ ਮੈਂ ਉਹਨੂੰ ਨਾ ਓਨਲਾਈਨ ਆਰਡਰ ਕਰਤਾ ਅਤੇ ਐਮਾਜੋਨ ਵਾਲਿਆਂ ਕੋਲ ਨਾ ਹੁਣ ਮੈਂ ਗੱਲ ਵੀ ਕੀਤੀ ਹੋਈ ਹੈ ਅਤੇ ਉਹ ਕਹਿੰਦੇ ਘੜੀ ਤੁਹਾਨੂੰ ਨਾ ਦਸ ਤੱਕ ਮਿਲ ਜਾਵੇਗੀ ਅਤੇ ਹੁਣ ਵੇਖਦੇ ਹਾਂ ਵੀ ਉਹ ਕਿੰਨਾ ਕੁ ਟਾਈਮ ਲੈ ਕੇ ਅਤੇ ਘੜੀ ਉਹਦੇ 'ਤੇ ਉਹ ਨਾਲ ਕਹਿੰਦੇ ਵੀ ਤੁਸੀਂ ਇਹਦੀ ਨਾ ਲੋਕੇਸ਼ਨ ਵੀ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਉਹ ਆਰਡਰ ਕੀਤਾ ਹੋਇਆ ਮਟੀਰੀਅਲ ਕ ਕਿੱਥੋਂ ਤੱਕ ਪਹੁੰਚ ਗਿਆ ਕਿੱਥੋਂ ਤੱਕ ਨਹੀਂ ਪਹੁੰਚਿਆ ਇਹ ਵੀ ਤੁਸੀਂ ਜਾਣ ਸਕਦੇ ਹੋ ਅਤੇ ਮੈਨੂੰ ਨਾ ਬਹੁਤ ਵਧੀਆ ਲੱਗਿਆ ਵੀ ਉਹਨਾਂ ਦੀ ਜਾਣਕਾਰੀ ਸਹੀ ਸੀ ਅਤੇ ਉਹ ਮੈਨੂੰ ਲੱਗਦਾ ਵੀ ਦਸ ਨੂੰ ਉਹ ਸਾਡੇ ਕੋਲ ਪਹੁੰਚਾ ਦੇਣਗੇ ਅਤੇ ਵੇਖੋ ਹੁਣ ਉਹ ਮੈਂ ਮੇਰੇ ਭਰਾ ਨੂੰ ਦੇਣੀ ਹੈ ਅਤੇ ਦੇਖੋ ਕਦੋਂ ਤੱਕ ਆਊ ਅਤੇ ਵੇ ਵੇਖਦੇ ਹਾਂ ਅਤੇ ਇਹ ਨਾ ਦ ਮੈਨੂੰ ਫਿਰ ਮੈਂ ਟਾਈਮ ਲੈ ਕੇ ਵੇਖਿਆ ਨਾ ਅਤੇ ਮੈਨੂੰ ਦਸ ਨੂੰ ਉਹ ਘੜੀ ਮਿਲ ਗਈ ਸੀ ਅਤੇ ਇਹ ਨਾ ਸਾਡੀ ਸਪੁਰਦਗੀ ਮਿਤੀ 'ਤੇ ਪਹੁੰਚਾ ਦਿੱਤੀ ਅਤੇ ਉਨ ਉਹ ਨਾ ਮੇਰੇ ਉਮੀਦਾਂ ਨਾਲ ਵੀ ਮੇਲ ਖਾਣ ਖਾਂਦੀ ਪਈ ਸੀ ਅਤੇ ਮੈਨੂੰ ਉਮੀਦ ਸੀ ਵੀ ਦਸ ਨੂੰ ਆ ਜਾਵੇ ਅਤੇ ਉਹਨਾਂ ਨੇ ਦਸ ਨੂੰ ਸਾਨੂੰ ਪਹੁੰਚਾ ਦਿੱਤੀ